ਅੱਜ ਦੇ ਸਮੇਂ ਵਿੱਚ ਪੰਜਾਬੀ ਭਾਸ਼ਾ ਬਾਰੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਚੱਲ ਰਹੀਆਂ ਹਨ ਲੋਕ ਦਫ਼ਤਰਾਂ ਵਿੱਚ ਮੌਲਾਂ ਵਿੱਚ ਦੁਕਾਨਾਂ 'ਤੇ ਜਾ ਕੇ ਹਿੰਦੀ ਅਤੇ ਅੰਗਰੇਜ਼ੀ ਬੋਲ ਕੇ ਖੁਸ਼ ਹੁੰਦੇ ਹਨ ਹੋਰ ਤਾਂ ਹੋਰ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਹਿੰਦੀ ਅਤੇ ਅੰਗਰੇਜ਼ੀ ਬੋਲਣ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ ਜਦੋਂ ਮਾਪੇ ਵੀ ਆਪਣੇ ਬੱਚਿਆਂ ਦੇ ਸਕੂਲ ਜਾਂਦੇ ਹਨ ਤਾਂ ਉਹ ਵੀ ਵੀ ਦੇਖੋ ਦੇਖੀ ਮਜ ਟੀਚਰਾਂ ਨੂੰ ਦੇਖ ਕੇ ਵਿਚਾਰੇ ਹਿੰਦੀ ਹੀ ਬੋਲਦੇ ਹਨ ਕਈਆਂ ਨੂੰ ਤਾਂ ਹਿੰਦੀ ਢੰਗ ਨਾਲ ਬੋਲਣੀ ਵੀ ਨਹੀਂ ਆਉਂਦੀ ਪਰ ਦੇਖੋ ਦੇਖੀ ਉਹ ਵੀ ਹਿੰਦੀ ਵੱਲ ਹੀ ਭੱਜਦੇ ਹਨ ਪੰਜਾਬੀ ਨਾਲ ਤਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਅਸੀਂ ਪੰਜਾਬੀ ਬੋਲੀ ਬੋਲਾਂਗੇ ਤਾਂ ਅਸੀਂ ਅਨਪੜ੍ਹ ਜਿਹੇ ਨਾ ਮਹਿਸੂਸ ਹੋਈਏ ਪੰਜਾਬੀ ਬੋਲੀ ਨੂੰ ਬੋਲ ਕੇ ਲੋਕ ਆਪਣੇ ਆਪ 'ਚ ਸ਼ਰਮ ਮਹਿਸੂਸ ਕਰਦੇ ਹਨ ਪਰ ਅਸਲ ਵਿੱਚ ਤਾਂ ਸਾਡੀ ਮਾਤ ਭਾਸ਼ਾ ਪੰਜਾਬੀ ਹੈ ਲੋਕਾਂ ਨੂੰ ਪੰਜਾਬੀ ਬੋਲੀ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਪਰ ਇਸ ਤੋਂ ਉਲਟ ਲੋਕ ਪੰਜਾਬੀ ਬੋਲੀ ਤੋਂ ਭੱਜ ਰਹੇ ਹਨ ਤਾਂ ਇਹਨਾਂ ਧਾਰਨਾਵਾਂ ਨੂੰ ਸਹੀ ਕਰਨ ਲਈ ਹੱਲ ਤਾਂ ਇਹੀ ਆ ਨਾ ਕਿ ਅਸੀਂ ਆਪਣੀ ਪੰਜਾਬੀ ਭਾਸ਼ਾ ਅੱਗੇ ਲਿਆਈਏ ਘਰਾਂ ਵਿੱਚ ਦੁਕਾਨਾਂ ਵਿੱਚ ਦਫ਼ਤਰਾਂ 'ਚ ਇ ਇੱਥੋਂ ਤੱਕ ਕਿ ਸਕੂਲਾਂ ਵਿੱਚ ਵੀ ਪੰਜਾਬੀ ਬੋਲੀ ਬੋਲੀ ਜਾਣੀ ਚਾਹੀਦੀ ਆ ਆਪਣੇ ਬੱਚਿਆਂ ਨਾਲ ਵੀ ਸਾਨੂੰ ਘਰਾਂ ਵਿੱਚ ਪੰਜਾਬੀ ਬੋਲਣੀ ਚਾਹੀਦੀ ਆ ਤਾਂ ਜਾਂ ਉਹਨਾਂ ਨੂੰ ਵੀ ਆਪਣੇ ਵਿਰਸੇ ਦਾ ਪਤਾ ਲੱਗੇ ਆਪਣੀ ਮਾਤ ਭਾਸ਼ਾ ਦਾ ਪਤਾ ਲੱਗੇ ਹੁਣ ਤਾਂ ਵਿਦੇਸ਼ਾਂ ਵਿੱਚ ਵੀ ਪੰਜਾਬੀ ਲਾਜ਼ਮੀ ਹੋ ਗਈ ਹੈ ਫਿਰ ਅਸੀਂ ਪੰਜਾਬ ਵਿੱਚ ਰਹਿ ਕੇ ਵੀ ਪੰਜਾਬੀ ਬੋਲੀ ਤੋਂ ਕਿਉਂ ਭੱਜ ਰਹੇ ਹਾਂ ਸਾਨੂੰ ਆਪਣੀ ਪੰਜਾਬੀ ਬੋਲੀ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ